ਨਹੀਂ ਮੈਂ ਕਦੇ ਵੀ ਕਿਸੇ ਸਮੂਹ ਜਾਂ ਕਿਸੇ ਕਲੱਬ ਵਿੱਚ ਸ਼ਾਮਿਲ ਨਹੀਂ ਹੋਈ ਕਿਉਂਕਿ ਇਹ ਮੈਨੂੰ ਚੰਗਾ ਨਹੀਂ ਲੱਗਦਾ ਇਹ ਇਹਦੇ ਵਿੱਚ ਕੀ ਹੈ ਬਹੁਤ ਦੌੜ ਭੱਜ ਵਾਲਾ ਕੰਮ ਹੈ ਇੱਕ ਮੈਂ ਇੱਕ ਹਾਊਸ ਵਾਈਫ ਹੋਣ ਦੇ ਨਾਤੇ ਮੈਂ ਕਦੇ ਇਸ ਚੀਜ਼ ਬਾਰੇ ਸੋਚਿਆ ਨਹੀਂ ਕਿਉਂਕਿ ਆਪਣੇ ਘਰ ਦੇ ਰੁਝੇਵੇਂ ਹੀ ਬਹੁਤ ਹੁੰਦੇ ਨੇ ਵੀ ਹਾਂ ਆਪਾਂ ਲੋਕ ਇਹੋ ਜਿਹੇ ਸਮੂਹਾਂ ਦੇ ਵਿੱਚ ਸ਼ਾਮਿਲ ਹੋ ਸਕੀਏ ਘਰ ਦੇ ਵਿੱਚ ਚ ਵਧੀਆ ਪਰਿਵਾਰ ਹੈ ਬੱਚੇ ਨੇ ਜਿਸ ਕਲੱਬਾਂ ਦੇ ਵਿੱਚ ਪਾਰਟੀਸਪੇਟ ਕਰਾਂਗੇ ਇਹਨਾਂ ਵਿੱਚ ਸ਼ਾਮਿਲ ਹੋਵਾਂਗੇ ਤਾਂ ਕੀ ਹੁੰਦਾ ਇਹਦੇ ਨਾਲ ਟਾਈਮ ਦੀ ਖਪਤ ਹੁੰਦੀ ਹੈ ਅਤੇ ਆਪਣੇ ਪਰਿਵਾਰ ਵੱਲ ਧਿਆਨ ਨਹੀਂ ਦਿੱਤਾ ਜਾਂਦਾ